ਹੈਲੋ ਹਾਂਜੀ ਮੈਮ ਡੀ ਸੀ ਔਫਿਸ ਤੋਂ ਗੱਲ ਕਰ ਰਹੇ ਹੋ ਹਾਂਜੀ ਮੈਮ ਮੇਰਾ ਨਾਮ ਕਿਰਨਜੋਤ ਕੌਰ ਹੈ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ ਐੱਸ ਸੀ ਦੀ ਡਿਗਰੀ ਕੰਪਲੀਟ ਕੀਤੀ ਸੀ ਦੋ ਹਜ਼ਾਰ ਤੇਈ ਦੇ ਵਿੱਚ ਪਰ ਅਜੇ ਤੱਕ ਮੈਨੂੰ ਆਪਣੀ ਡਿਗਰੀ ਨਹੀਂ ਮਿਲੀ ਹੈ ਤਾਂ ਮੈਨੂੰ ਤੁਸੀਂ ਦੱਸ ਸਕਦੇ ਹੋ ਕਿ ਕਿ ਕਿਹੜੇ ਕਿਹੜੇ ਡਾਕੂਮੈਂਟਸ ਰਿਕੁਆਰਡ ਹੁੰਦੇ ਨੇ ਮਤਲਬ ਜਿਨ੍ਹਾਂ ਦੀ ਹਾਂਜੀ ਮੈਮ ਸ ਉਦੋਂ ਮੈਂ ਆਪਣੀਆਂ ਛੇਵੇਂ ਛੇ ਸਮੈਸਟਰ ਦੀ ਮਾਰਕਸ਼ੀਟ ਇੱਕ ਆਪਣਾ ਆਈ ਡੀ ਕਾਰਡ ਸਬਮਿਟ ਕੀਤਾ ਸੀ ਇਸ ਤੋਂ ਇਲਾਵਾ ਮੈਂ ਕੋਈ ਡਾਕੂਮੈਂਟ ਉੱਥੇ ਸਬਮਿਟ ਨਹੀਂ ਕੀਤਾ ਹੈ ਅੱਛਾ ਮੈਮ ਮੇਰਾ ਇੱਕ ਹੋਰ ਕੋਸ਼ਚਨ ਸੀਗਾ ਜਿਹੜਾ ਆਧਾਰ ਕਾਰਡ ਹੈ ਉਹਦੇ ਉੱਪਰ ਮੇਰਾ ਜਿਹੜਾ ਫ਼ੋਨ ਨੰਬਰ ਹੈੈੈੈੈੈ ਉਹ ਅਪਡੇਟਡ ਨਹੀਂ ਹੈ ਤਾਂ ਮੈਂ ਅਪ ਆਪਣਾ ਆਧਾਰ ਕਾਰਡ ਕਿਹੜਾ ਸਬਮਿਟ ਕਰਾਂ ਅੱਛਾ ਇਸ ਤੋਂ ਇਲਾਵਾ ਕੋਈ ਹੋਰ ਡਾਕੂਮੈਂਟ ਦੀ ਲੋੜ ਤਾਂ ਨਹੀਂ ਪਵੇਗੀ ਨਾ ਮੈਮ ਬਾਕੀ ਡਿਗਰੀ ਮੈਨੂੰ ਆਪਣੇ ਆਪ ਘਰ ਮਿਲ ਜਾਵੇਗੀ ਜਾਂ ਉੱਥੇ ਲੈ ਕੇ ਆਉਣੀ ਪਵੇਗੀ ਮੈਂ ਕਹਿ ਰਹੀ ਸੀ ਮੈਨੂੰ ਡਿਗਰੀ ਘਰ ਮਿਲ ਜਾਵੇਗੀ ਜਾਂ ਮੈਨੂੰ ਉੱਥੋਂ ਲੈ ਕੇ ਆਉਣੀ ਪਵੇਗੀ ਠੀਕ ਹੈ ਮੈਮ ਧੰਨਵਾਦ ਠੀਕ ਹੈ ਮੈਮ ਧੰਨਵਾਦ